ਤੇਈ ਨਵੰਬਰ ਦੋ ਹਜ਼ਾਰ ਪੱਚੀ ਸੌਲਾਂ ਸਤੰਬਰ ਦੋ ਹਜ਼ਾਰ ਨੌ ਸਤਾਰਾਂ ਜਨਵਰੀ ਉੱਨੀ ਸੌ ਚਾਲੀ ਛੱਬੀ ਅਪ੍ਰੈਲ ਉੱਨੀ ਸੌ ਚੁਰਾਸੀ ਪੰਦਰਾਂ ਅਗਸਤ ਉੱਨੀ ਸੌ ਚਾਲੀ